ਹਾਂ ਅਸੀਂ ਸਿੱਧੀ ਅੱਗ ਚੁੱਲ੍ਹੇ 'ਤੇ ਖਾਣਾ ਪਕਾਇਆ ਹੋਇਆ ਹੈ ਇਹ ਗੈਸ ਇੰਡਕਸ਼ਨ ਤੋਂ ਇਸ ਕਰਕੇ ਵੱਖਰਾ ਹੈ ਜੋ ਅੱਗ ਹੁੰਦੀ ਹੈ ਉਹ ਲੱਕੜੀਆਂ ਦੀ ਅੱਗ ਹੁੰਦੀ ਹੈ ਅਤੇ ਚੁੱਲ੍ਹੇ 'ਤੇ ਖਾਣਾ ਬਣਾਉਣ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਚੁੱਲ੍ਹੇ 'ਤੇ ਜੋ ਖਾਣਾ ਬਣਾਇਆ ਜਾਂਦਾ ਹੈ ਉਹ ਬਹੁਤ ਹੀ ਘਰੇਲੂ ਹੁੰਦਾ ਹੈ ਅਤੇ ਖਾਣ ਵਿੱਚ ਵੀ ਬੜਾ ਸੁਆਦ ਹੁੰਦਾ ਹੈ ਅਤੇ ਜੋ ਗੈਸ ਅਤੇ ਇੰਡਕਸ਼ਨ 'ਤੇ ਬਣਾਇਆ ਜਾਂਦਾ ਹੈ ਉਸ ਦਾ ਸੁਆਦ ਵੱਖਰਾ ਹੀ ਹੁੰਦਾ ਹੈ ਇਸ ਨਾਲ ਕਈ ਸਾਰੀਆਂ ਬਿਮਾਰੀਆਂ ਵੀ ਲੱਗ ਸਕਦੀਆਂ ਹਨ